ਪੀ ਟੀ ਊਸ਼ਾ ਸਾਡੇ ਦੇਸ਼ ਦੀ ਮਹਾਨ ਅਥਲੀਟ ਰਹਿ ਚੁੱਕੀ ਹੈ ਅਤੇ ਉਸਨੇ ਸਾਡੇ ਦੇਸ਼ ਲਈ ਬੜੇ ਹੀ ਮੈਡਲ ਲਿਆਂਦੇ ਹਨ ਇਸ ਤੋਂ ਸਾਨੂੰ ਇਹ ਸਿੱਖਣਾ ਚਾਹੀਦਾ ਹੈ ਕਿ ਸਾਨੂੰ ਸਾਰਿਆਂ ਨੂੰ ਖੇਡਾਂ ਦੇ ਮੈਦਾਨ ਵਿੱਚ ਰਲ ਮਿਲ ਕੇ ਹੰਭਲੇ ਮਾਰਨੇ ਚਾਹੀਦੇ ਹਨ ਅਤੇ ਹੋਰ ਵੱਧ ਤੋਂ ਵੱਧ ਮੈਡਲ ਲਿਆਉਣ ਲਈ ਬੱਚਿਆਂ ਨੂੰ ਪ੍ਰੇਰਿਤ ਕਰਨਾ ਚਾਹੀਦਾ ਹੈ